ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਅ ਜੀ ਤੁਸੀਂ ਜੱਗੀ ਸਵੀਟ ਤੋਂ ਬੋਲਦੇ ਹੋ ਜੀ ਹਾਂਜੀ ਭਾਅ ਜੀ ਅਸੀਂ ਆਡਰ ਦੇਣਾ ਸੀ ਜੀ ਹਾਂਜੀ ਹਾਂਜੀ ਭਾਅ ਜੀ ਸਮੋਸੇ ਮੰਗਵਾਉਣੇ ਸੀ ਜੀ ਅਸੀਂ ਅਤੇ ਬਰਗਰ ਮੰਗਵਾਉਣਾ ਸੀ ਸਾਡੇ ਰਿਸ਼ਤੇਦਾਰ ਆਏ ਨੇ ਘਰ ਹਾਂਜੀ ਹਾਂਜੀ ਭਾਅ ਜੀ ਭੇਜ ਦੋਗੇ ਤੁਸੀਂ ਹਾਂਜੀ ਲਿਖੋ ਆਡਰ ਜੀ ਪੀਜ਼ੇ ਦੋ ਹਾਂਜੀ ਦਸ ਸਮੋਸੇ ਜੀ ਹਾਂਜੀ ਬਰਫ਼ੀ ਦਾ ਇੱਕ ਡੱਬਾ ਭੇਜ ਦਿਉ ਕਿੱਲੋ ਬਰਫ਼ੀ ਹਾਂਜੀ ਕਿੱਲੋ ਗੁਲਾਬ ਜਾਮੁਨਾਂ ਹਾਂਜੀ ਭਾਅ ਜੀ ਪਤਾ ਨੋਟ ਕਰੋ ਜੀ ਹਾਂਜੀ ਲਿਖੋ ਜੀ ਖਾਲਸਾ ਕਲੋਨੀ ਗਲੀ ਨੰਬਰ ਤਿੰਨ ਹਾਊਸ ਨੰਬਰ ਪੰਜ ਸੌ ਸੱਤ ਹਾਂਜੀ ਪਟਿਆਲਾ ਜੀ ਜੀ ਤੁਸੀਂ ਪੈਸੇ ਗੂਗਲ ਪੇਅ ਕਰ ਦੀਏ ਕਿ ਕੈਸ਼ ਪੇਮੈਂਟ ਲਓਗੇ ਹਾਂਜੀ ਗੂਗਲ ਪੇਅ ਕਰ ਦੀਏ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਭਾਅ ਜੀ ਠੀਕ ਹੈ ਜੀ ਗੂਗਲ ਪੇਅ ਕਰ ਦਿੰਦੇ ਹਾਂ ਹਾਂਜੀ ਹਾਂਜੀ ਭਾਅ ਜੀ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਓਕੇ